ਸਾਡੇ ਲਈ ਪੰਜਾਬੀ ਭਾਸ਼ਾ ਹੋਰ ਭਾਸ਼ਾਵਾਂ ਨਾਲੋਂ ਪੜ੍ਹਨੀ ਅਤੇ ਸਮਝਣੀ ਆਸਾਨ ਹੈ ਕਿਉਂਕਿ ਇਹ ਸਾਡੀ ਮਾਂ ਬੋਲੀ ਅਸੀਂ ਪੰਜਾਬ ਦੇ ਵਸਨੀਕ ਹੋਣ ਕਰਕੇ ਪੰਜਾਬੀ ਭਾਸ਼ਾ ਨੂੰ ਸ਼ੁਰੂ ਤੋਂ ਹੀ ਸਮਝਦੇ ਅਤੇ ਬੋਲਦੇ ਹਾਂ ਹੋਰ ਭਾਸ਼ਾਵਾਂ ਨੂੰ ਸਮ ਸਾਨੂੰ ਪਹਿਲਾਂ ਸਿੱਖਣਾ ਪਵੇਗਾ ਸਮਝਣਾ ਪਵੇਗਾ ਜੋ ਕਿ ਸਾਡੇ ਲਈ ਆਸਾਨ ਨਹੀਂ ਹੈ ਅਸੀਂ ਸਾਡੇ ਪਰਿਵਾਰ ਮੈਂ ਪਰਿਵਾਰਕ ਮੈਂਬਰਾਂ ਵਿੱਚ ਬੋਲੀ ਇਹ ਵੀ ਘੱਟ ਜਾਂਦੀ ਹੈ ਸਾਡੇ ਪਰਿਵਾਰ ਵਿੱਚ ਇਕੱਲੀ ਪੰਜਾਬੀ ਹੀ ਪੰਜਾਬੀ ਵਿੱਚ ਹੀ ਗੱਲ ਕੀਤੀ ਜਾਂਦੀ ਹੈ ਇਸ ਲਈ ਪੰਜਾਬੀ ਭਾਸ਼ਾ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਅਸੀਂ ਪੰਜਾਬ ਪੰਜਾਬ ਵਿੱਚ ਹੀ ਜੰਮੇ ਪਲੇ ਹਾਂ ਸਾਨੂੰ ਪੰਜਾਬੀ ਭਾਸ਼ਾ ਨਾਲ ਮੋਹ ਲਗਾਉ ਹੈ ਪੰਜਾਬੀ ਭਾਸ਼ਾ ਹੋਰ ਭਾਸ਼ਾਵਾਂ ਨਾਲੋਂ ਇੱਕ ਵੱਖਰੀ ਹੈ ਇਹਨੂੰ ਇਸ ਨੂੰ ਕੋਈ ਹਰ ਇੱਕ ਬੋਲ ਸਕਦਾ ਹੈ ਹਰ ਇੱਕ ਸਮਝ ਜਲਦੀ ਸਕਦਾ ਹੈ ਇਸ ਲਈ ਇਹ ਹੋਰ ਭਾਸ਼ਾਵਾਂ ਨਾਲੋਂ ਕਿਤੇ ਜ਼ਿਆਦਾ ਸਿੱਖਣੀ ਅਤੇ ਸਮਝਣੀ ਸੌਖੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਵਿਦਵਾਨ ਹੋਏ ਹਨ ਇਸ ਕਰਕੇ ਸਮਝਣੀ ਸੌਖੀ ਹੈ